ਹਾਂਜੀ ਨੇਪਾਲ ਦੇ ਵਿੱਚ ਆਪਣੇ ਇੱਕ ਬੁਰਜ ਹੈ ਜੀ ਉਹ ਠੰਡਾ ਬੁਰਜ ਹੈ ਜੀ ਬਹੁਤ ਵਧੀਆ ਸਭ ਤੋਂ ਵਧੀਆ ਸ ਘੁੰਮਣੇ ਵਾਲੀ ਜਗ੍ਹਾ ਹੈਗੀ ਹੈ ਜਿਵੇਂ ਹੁਣ ਚੰਡੀਗੜ੍ਹ ਦੇ ਵਿੱਚ ਹੋ ਗਿਆ ਸਤਾਰ੍ਹਾਂ ਸੈਕਟਰ ਉਹ ਵੀ ਵਧੀਆ ਘੁੰਮਣ ਵਾਲੀ ਜਗ੍ਹਾ ਹੈ ਇੱਕ ਆਪਣੇ ਮੰਨ ਲਓ ਜੀ ਹੋਰ ਨੇੜੇ ਨੇੜੇ ਹੋ ਗਏ ਬਠਿੰਡੇ ਦਾ ਕਿਲ੍ਹਾ ਹੋ ਗਿਆ ਜੀ ਬਹੁਤ ਵਧੀਆ ਦੇਖਣ ਵਾਲੀ ਚੀਜ਼ ਹੈ ਇਹਦੀ ਸੁਰੰਗ ਬਹੁਤ ਲੰਮੀ ਜਾਂਦੀ ਸੀਗੀ ਜੀ ਲਾਹੌਰ ਦੇ ਲਾਗੇ ਬਾਗੇ ਨਿਕਲਣ ਵਾਲੀ ਸੁਰੰਗ ਸੀ ਪਹਿਲਾਂ ਦੇ ਰਾਜਿਆਂ ਦੀ ਕਿਲ੍ਹੇ ਦੀ ਸਭ ਤੋਂ ਨਿੱਕੀ ਇੱਟ ਹੈ ਇਹ ਜੀ ਕਿਲ੍ਹੇ ਦੇ ਵਿੱਚ ਤਾਂ ਕਰਕੇ ਸਭ ਤੋਂ ਵਧੀਆ ਚੀਜ਼ ਜੇ ਘੁੰਮਣ ਵਾਲੀ ਜਗ੍ਹਾ ਬਹੁਤ ਵਧੀਆ ਜੀ ਚੰਡੀਗੜ ਦੀ ਹੋਗੀ ਹੈ ਜੀ ਠੀਕ ਹੈ ਦਿੱਲੀ ਦੇ ਲਾਲ ਕਿਲ੍ਹਾ ਹੋ ਗਿਆ ਸਭ ਤੋਂ ਵਧੀਆ ਜੀ ਇਹ ਚੀਜ਼ ਘੁੰਮਣ ਵਾਲੀ ਜਗ੍ਹਾ ਜੀ ਦੇਖਣ ਵਾਲੀਆਂ ਚੀਜ਼ਾ ਠੀਕ ਆ ਆਪਣੇ ਇੱਧਰ ਹੋ ਗਈ ਜੀ ਰਾਜਸਥਾਨ ਦੇ ਵਿੱਚ ਹੋ ਗਿਆ ਅਮਰਨਾਥ ਹੋ ਗਿਆ ਜੀ ਜਾਣ ਖਤਰੇ ਦੀ ਯਾਤਰਾ ਬਹੁਤ ਜ਼ਬਰਦਸਤ ਚੀਜ਼ ਵਾਲਾ ਦੇਖਣ ਖਾਤਰ ਬਹੁਤ ਵਧੀਆ ਚੀਜ਼ ਆ ਜੀ ਆਪਣੇ ਦੁਬਈ ਦੇ ਵਿੱਚ ਗੋਆ ਹੋ ਗਿਆ ਗੋਆ ਦੇ ਵਿੱਚ ਸਮੁੰਦਰ ਆ ਸਮੁੰਦਰ ਦੇ ਨਾਲ ਜੀ ਕਦੇ ਸਮੁੰਦਰ ਦੇ ਨਾਲ ਉੱਥੇ ਮੰਨ ਲਓ ਜੀ ਬਹੁਤ ਦੂਰ ਦੂਰ ਦੇ ਬਾਹਰਲੇ ਦੇਸ਼ਾਂ ਦੇ ਲੋਕ ਆਉਂਦੇ ਹਨ ਦੇਖਣ ਖਾਤਰ ਜੀ ਜਾਣਾ ਹੋਵੇ ਜਗ੍ਹਾ ਦੇਖਣ ਖਾਤਰ ਉੱਥੇ ਠੰਡੀ ਹਵਾ ਆਊਗੀ ਲਹਿਰਾਂ ਆਉਂਦੀਆਂ ਸਮੁੰਦਰ ਦੀਆਂ ਜੀ ਉਹ ਚੀਜ਼ ਬਹੁਤ ਵਧੀਆ ਬੰਬੇ ਦੇ ਵਿੱਚ ਗੋਆ ਘੁੰਮਣ ਖਾਤਰ ਜੀ ਬਹੁਤ ਤਕੜੇ ਤਕੜੇ ਬਹੁਤ ਵਧੀਆ ਚੀਜ਼ਾਂ ਜੀ ਉੱਥੇ ਆਪਣੇ ਬੰਬੇ ਦੇ ਵਿੱਚ ਜੀ